ਹਾਂਜੀ ਦਿਨ ਦੇ ਦੌਰਾਨ ਹਰ ਵਿਅਕਤੀ ਨੂੰ ਪਾਣੀ ਦੀ ਲੋੜ ਪੈਂਦੀ ਆ ਪਰ ਪਾਣੀ ਦੀ ਲੋੜ ਉਸ ਸਮੇਂ ਪੈਂਦੀ ਹੈ ਜਿਸ ਸਮੇਂ ਵਿਅਕਤੀ ਅਲੱਗ ਅਲੱਗ ਕੰਮ 'ਤੇ ਅਧਾਰਿਤ ਹੁੰਦਾ ਹੈ ਜਿਵੇਂ ਕਿ ਮਿਹਨਤੀ ਵਿਅਕਤੀ ਕੋਈ ਬੱਠਲ ਜਾਂ ਕਹੀ ਚਲਾਉਂਦਾ ਹੈ ਤਾਂ ਉਸਨੂੰ ਦਿਨ ਵਿੱਚ ਵੱਖ ਵੱਖ ਸਮੇਂ 'ਤੇ ਪਾਣੀ ਦੀ ਲੋੜ ਪੈਂਦੀ ਹੈ ਪਰ ਕੁਝ ਇਹੋ ਜਿਹੇ ਵੀ ਵਿਅਕਤੀ ਹੁੰਦੇ ਹਨ ਜੋ ਬੈਠਣ ਵਾਲੀ ਸੀਟ 'ਤੇ ਕੰਮ ਕਰਦੇ ਹਨ ਉਹਨਾਂ ਨੂੰ ਦਿਨ ਵਿੱਚ ਇੱਕ ਜਾਂ ਦੋ ਤਿੰਨ ਵਾਰ ਪਾਣੀ ਦੀ ਲੋੜ ਪੈਂਦੀ ਹੈ ਇਹ ਪਾਣੀ ਦੀ ਲੋੜ ਵਿਅਕਤੀ ਦੇ ਵੱਖ ਵੱਖ ਕੰਮਕਾਜ ਉੱਤੇ ਅਧਾਰਿਤ ਹੈ ਪਰ ਪਾਣੀ ਪੀਣਾ ਵੀ ਸਰੀਰ ਲਈ ਸਭ ਤੋਂ ਜ਼ਰੂਰੀ ਹੈ ਜੋ ਵਿਅਕਤੀ ਦੇ ਸਰੀਰ ਦੇ ਅੰਦਰਲੇ ਅੰਗਾਂ ਦੀ ਸਫਾਈ ਕਰਦਾ ਹੈ ਜਾਂ ਪੇਟ ਦੀ ਸਫਾਈ ਕਰਦਾ ਹੈ ਪਾਣੀ ਪੀਣ ਦੇ ਨਾਲ ਵਿਅਕਤੀ ਦੀਆਂ ਵੱਖ ਵੱਖ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ ਅਤੇ ਕਾਫੀ ਬਿਮਾਰੀਆਂ ਤੋਂ ਬਚਦਾ ਵੀ ਹੈ ਇਸ ਲਈ ਦਿਨ ਦੇ ਦੌਰਾਨ ਪਾਣੀ ਦੀ ਲੋੜ ਸਭ ਨੂੰ ਹੁੰਦੀ ਹੈ